ਸਾਡੀਆਂ ਜਿਹੜੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਨੇ ਸਭ ਦੇ ਨਾਲ ਚੰਗਾ ਬੋਲਣਾ ਮਿੱਠਾ ਬੋਲਣਾ ਅਤੇ ਸਭ ਦੇ ਨਾਲ ਸਤਿਕਾਰ ਦੇ ਨਾਲ ਬੋਲਣਾ ਇਹ ਸਾਡੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਨੇ ਅਤੇ ਕਮਜ਼ੋਰੀ ਸ ਅ ਕਮਜ਼ੋਰੀਆਂ ਜਿਹੜੀਆਂ ਸਾਡੇ ਵਿੱਚ ਨੇ ਉਹ ਹੈਗਾ ਕਿ ਸਭ 'ਤੇ ਬਹੁਤ ਚੰਗੀ ਬਹੁਤ ਜਲਦੀ ਵਿਸ਼ਵਾਸ ਕਰ ਲੈਣਾ ਅਤੇ ਸਭ ਦੇ ਨਾਲ ਸਭ ਦੀਆਂ ਗੱਲਾਂ ਦੇ ਜਲਦੀ ਗੱਲਾਂ ਦੇ ਵਿੱਚ ਆ ਜਾਣਾ ਇਹ ਸਾਡੀਆਂ ਵੱਡੀਆਂ ਕਮਜ਼ੋਰੀਆਂ ਨੇ